ਜਦੋਂ ਮੈਨੂੰ ਆਪਣੇ ਫੋਨ ਕੰਪਿਊਟਰ ਜਾਂ ਲੈਪਟੋਪ 'ਤੇ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਮੈਂ ਆਪਣੇ ਬੇਟੇ ਨਾਲ ਸਲਾਹ ਕਰਦੀ ਹਾਂ ਕਿਉਂਕਿ ਉਹ ਕੰਪਿਊਟਰ ਵਿੱਚ ਕਾਫੀ ਮਾਹਿਰ ਹੈ ਅਤੇ ਇਸ ਤੋਂ ਇਲਾਵਾ ਸਾਡੇ ਖੇਤਰ ਵਿੱਚ ਦੋ ਕੰਪਿਊਟਰ ਸੈਂਟਰ ਹਨ ਸੰਗਮ ਕੰਪਿਊਟਰ ਸੈਂਟਰ ਅਤੇ ਗੀਤਾ ਸੋਫਟੈਕ ਇਹ ਸੈਂਟਰ ਤੁਹਾਨੂੰ ਕਿਸੇ ਵੀ ਸਮੱਸਿਆ ਨੂੰ ਬੜੇ ਆਸਾਨ ਤਰੀਕੇ ਨਾਲ ਹੱਲ ਕਰਨ ਵਿੱਚ ਸਹਾਇਤਾ ਕਰਦੇ ਹਨ ਇੱਥੇ ਬਹੁਤ ਵਧੀਆ ਸੋਫਟਵੇਅਰ ਐਕਸਪਰਟ ਹਨ ਹਾਰਡਵੇਅਰ ਐਕਸਪਰਟ ਹਨ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਆਉਂਦੀ ਹੈ ਜੋ ਤੁਸੀਂ ਖੁਦ ਘਰ ਹੱਲ ਨਹੀਂ ਕਰ ਸਕਦੇ ਤਾਂ ਤੁਸੀਂ ਇਹਨਾਂ ਸੈਂਟਰਸ 'ਤੇ ਜਾ ਕੇ ਆਪਦੀ ਸਮੱਸਿਆ ਦੱਸ ਕੇ ਉਹਨਾਂ ਤੋਂ ਆਪਦਾ ਹੱਲ ਲੈ ਸਕਦੇ ਹੋ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਇੱਥੇ ਸਮਝਾਇਆ ਜਾਂਦਾ ਹੈ ਐਕਸਪਰਟਸ ਆਲਵੇਜ ਤੁਹਾਡੀ ਹੈਲਪ ਕਰਨ ਨੂੰ ਤਿਆਰ ਬੈਠੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਹਾਰਡਵੇਅਰ ਜਾਂ ਸੋਫਟਵੇਅਰ ਜਾਂ ਤਕਨੀਕੀ ਤੁਹਾਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਲੋਕ ਤੁਹਾਡੀ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਕੇ ਤੁਹਾਡੀ ਮਦਦ ਕਰਦੇ ਹਨ ਸੋ ਸਾਡੇ ਖੇਤਰ ਦੇ ਕੰਪਿਊਟਰ ਸੈਂਟਰ ਜੋ ਹਨ ਬਹੁਤ ਵਧੀਆ ਹਨ ਅਤੇ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ